ਮੈਂ ਵਿਕਲਪ ਰਨਿੰਗ ਵਰਕ ਆਊਟ ਕਰਦਾ ਰਿਹਾ ਹਾਂ ਤੇ ਇਹ ਮੈਂ ਸ਼ੁਰੂ ਤੋਂ ਸ਼ੁਰੂ ਤੋਂ ਹੀ ਇਸ ਵਿੱਚ ਭਾਗ ਲੈਂਦਾ ਭਾਗ ਲੈਂਦਾ ਰਿਹਾ ਹਾਂ ਤੇ ਹੁਣ ਵੀ ਮੈਂ ਬੱਚਿਆਂ ਨੂੰ ਨਾਲ ਲੈ ਕੇ ਇਹ ਗਰਾਊਂਡ 'ਚ ਜਾ ਕੇ ਮੈਂ ਇਹ ਹਰ ਬਾਰ ਹਰ ਰੋਜ਼ ਤਾਂ ਮੇਰਾ ਰੂਟੀਨ ਹੀ ਐ ਕਿ ਮੈਂ ਕਰਦਾ ਰਹਿਣਾ ਇਹ ਦੌੜਨ ਨਾਲ ਮੈਨੂੰ ਬਹੁਤ ਤੰਦਰੁਸਤੀ ਮਿਲੀ ਹੈ ਤੇ ਅੱਜ ਤੱਕ ਮੈਨੂੰ ਵੀ ਮੈਨੂੰ ਕੋਈ ਵੀ ਮੇਰੇ ਗੋਡਾ ਕੋਈ ਕੁਦਤ ਸਰੀਰ ਨੂੰ ਥਕਾਵਟ ਕੁਛ ਵੀ ਅਜਿਹਾ ਅਜਿਹਾ ਨਹੀਂ ਹੁੰਦਾ ਮੇਰਾ ਹੱਡੀਆਂ ਵੀ ਇਸ ਨਾਲ ਮਜਬੂਤ ਹੁੰਦੀਆ ਤੇ ਇਸ ਦੌੜਨ ਦਾ ਇੱਕ ਆਮ ਮਨੁੱਖ ਵਾਸਤੇ ਬਹੁਤ ਚੰਗੀ ਚੰਗੀ ਚੀਜ਼ ਐ ਇਹ ਬਹੁਤ ਵਧੀਆ ਕਸਰਤ ਹੈ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਸ ਤੋਂ ਵੱਡਾ ਕੋਈ ਕੋਈ ਵੀ ਵਿਕਲਪ ਨੀ ਨਹੀਂ ਹੈ ਦੌੜਨਾ ਹਰ ਇੱਕ ਨੂੰ ਚਾਹੀਦਾ ਹੈ ਦੌੜਦੇ ਦੇ ਨਾਲ ਸਰੀਰ ਚ ਫੁਰਤੀ ਸਰੀਰ ਚ ਚੁਸਤੀ ਇਹ ਸਾਰੇ ਮੌਜੂਦ ਰਹਿੰਦੀਆਂ ਨੇ ਅਤੇ ਥਕਾਵਟ ਵੀ ਇਸ ਤੋਂ ਦੂ ਦੂਰ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਨਾਲ ਖੇਡਣ ਖੇ ਖੇਡਣ ਚ ਦੌੜਨ ਚ ਉੱਚੀ ਸਾਹ ਸਾਰਾ ਕੁਛ ਜੀ ਮੈਂ ਲਗਾਤਾਰ ਹੀ ਸੀ ਟਾਈਮ ਟਾਈਮ ਇਹਨੂੰ ਕਰਦੇ ਰਹਿੰਦੇ ਆਂ ਤੇ ਵਰਕਆਊਟ ਦੇ ਵੀ ਹਰੇਕ ਨੂੰ ਕਰਨੀ ਕਰਨੀ ਚਾਹੀਦੀ ਹੈ ਇਹੀ ਸਾਡਾ ਵਿਕਲਪ ਹੁੰਦਾ ਤੇ ਅੱਗੇ ਬੱਚਿਆਂ ਨੂੰ ਵੀ ਸਾਤੋਂ ਪ੍ਰੇਰਨਾ ਲੈ ਕੇ ਉਹ ਵੀ ਆਪਣਾ ਇਹ ਮਿਸ਼ਨ ਨੂੰ ਆਰੰਭ ਕਰ ਰਹੇ ਨੇ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਇਹ ਤੰਦਰੁਸਤ ਰਹਿਣ ਦਾ ਰਾਜ ਹੈ ਇੱਕ